ਜੇਕਰ ਕੰਮ ਤੋਂ ਬਾਅਦ ਸ਼ੌਂਕ ਦੀ ਗੱਲ ਕਰਈਏ ਤਾਂ ਮੇਰਾ ਇਹ ਹੀ ਸ਼ੌਂਕ ਹੈ ਕੀ ਮੈਂ ਕਿਤਾਬਾਂ ਪੜ੍ਹਨਾ ਚਾਹੁੰਦਾ ਹਾਂ ਕਿਤਾਬਾਂ ਇੱਦਾਂ ਦੀ ਹੋਵੇ ਜਿਹਦੇ ਨਾਲ ਸਾਨੂੰ ਕੁੱਝ ਮੋਟੀਵੇਸ਼ਨਲ ਮਿਲੇ ਅਤੇ ਵੱਧ ਤੋਂ ਵੱਧ ਮੈਂ ਜਾਣਕਾਰੀ ਇਕੱਠੀ ਕਰਨੀ ਚਾਹੁੰਦਾ ਹਾਂ ਕਿਤਾਬਾਂ ਪੜ੍ਹਕੇ ਅਤੇ ਆਪਣਾ ਟਾਇਮ ਬਤੀਤ ਕਰਨਾ ਚਾਹੁੰਦਾ ਹਾਂ ਅਤੇ ਮੈਨੂੰ ਹਿਸ਼ਟਰੀ ਦੀਆਂ ਕਿਤਾਬਾਂ ਪੜ੍ਹਨ ਦਾ ਵੀ ਸ਼ੌਂਕ ਹੈ ਉਹ ਵੀ ਪੜ੍ਹ ਲੈਂਦਾ ਹਾਂ ਜੇ ਦਿਲਚਸਪੀਆਂ ਦੀ ਗੱਲ ਕਰਈਏ ਤਾਂ ਫਿਰ ਜੋ ਹੋ ਜੋ ਹੋਰ ਵੀ ਟਾਇਮ ਬਚਦਾ ਹੈ ਉਹ ਆਪਣੇ ਪਰਿਵਾਰ ਨਾਲ ਬਿਤਾ ਕੇ ਉਹਨਾਂ ਦੀ ਕੋਈ ਸਮੱਸਿਆ ਨਾ ਉਹਨੂੰ ਮੁਸ਼ਕਿਲ ਤਾਂ ਨਹੀਂ ਆ ਰਹੀ ਉਹ ਦੇਖਣਾ ਚਾਹੁੰਦਾ ਹਾਂ ਬੱਚਿਆਂ ਦਾ ਦੇਖਣਾ ਚਾਹੁੰਦਾ ਹਾਂ ਕਿ ਉਹਨਾਂ ਦੀ ਪੜ੍ਹਾਈ ਚੱਲ ਰਹੀ ਹੈ ਕੋਈ ਉਹਨਾਂ ਨੂੰ ਪੜ੍ਹਾਈ ਵਿੱਚ ਦਿੱਕਤ ਤਾਂ ਨਹੀਂ ਆ ਰਹੀ ਜਾਂ ਫਿਰ ਹੋਰ ਉਹਨਾਂ ਦੀਆਂ ਭਾਵਨਾਵਾਂ ਕੀ ਹੈ ਉਹੋ ਉਹ ਦੇਖਣਾ ਚਾਹੁੰਦਾ ਹਾਂ